ਮੈਂ ਅਤੁਲ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਇੱਥੇ ਆਮ ਤੌਰ 'ਤੇ ਕਈ ਪੰਛੀ ਆਕਾਸ਼ ਵਿੱਚ ਉੱਡਦੇ ਰਹਿੰਦੇ ਹਨ ਅਤੇ ਉਹਨਾਂ ਨੂੰ ਆਕਰਸ਼ਿਤ ਕਰਨ ਲਈ ਸਾਡੇ ਕਈ ਤਰੀਕੇ ਹਨ ਜਿੱਦਾਂ ਕਿ ਮੇਰੇ ਦੋਸਤ ਜੋ ਕਿ ਕਬੂਤਰ ਪਾਲਦਾ ਹੈ ਉਹ ਜਦੋਂ ਵੀ ਕੋਈ ਪੰਛੀ ਦੇਖਦਾ ਹੈ ਉਹ ਦਾਣਾ ਸੁੱਟ ਕੇ ਕਬੂਤਰ ਬਾਹਰ ਕੱਢ ਦਿੰਦਾ ਹੈ ਜਦੋਂ ਕਿ ਕੋਈ ਕਬੂਤਰ ਉੱਡਦਾ ਹੋਇਆ ਥੱਲੇ ਕਬੂਤਰਾਂ ਨੂੰ ਵੇਖਦਾ ਹੈ ਉਹ ਖੁਦ ਉੱਥੇ ਆ ਜਾਂਦਾ ਹੈ ਜਿਹਦੇ ਨਾਲ ਕਿ ਉਹ ਖੁਦ ਉਹ ਕਬੂਤਰ ਨੂੰ ਪਕੜ ਸਕਦਾ ਹੈ ਜਾਂ ਦੇਖ ਸਕਦਾ ਹੈ ਕਿ ਇਹ ਸਭ ਤੋਂ ਵਧੀਆ ਤਰੀਕਾ ਹੈ ਇੱਕ ਕਬੂਤਰ ਵਗੈਰਾ ਨੂੰ ਆਕਰਸ਼ਿਤ ਕਰਨ ਲਈ ਉਸ ਤੋਂ ਇਲਾਵਾ ਜੇ ਤੁਸੀਂ ਆਪਣੇ ਕੋਠੇ ਵਗੈਰਾ ਸਾਫ ਰੱਖੋ ਅਤੇ ਉੱਥੇ ਦਾਣਾ ਅਤੇ ਪਾਣੀ ਰੱਖੋ ਅਤੇ ਕਬੂਤਰ ਆਮ ਤੌਰ 'ਤੇ ਆ ਕੇ ਦਾਨਾ ਪਾਣੀ ਜ਼ਰੂਰ ਖਾਂਦਾ ਹੈ ਜਿਹਦੀ ਵਜ੍ਹਾ ਨਾਲ ਕਿ ਕਬੂਤਰ ਆਕਰਸ਼ਿਤ ਹੋਏਗਾ ਹੋਰ ਵੀ ਉਸ ਤੋਂ ਇਲਾਵਾ ਜੇ ਤੁਸੀਂ ਖੁਦ ਹੀ ਕਬੂਤਰਾਂ ਦੇ ਲਈ ਕੋਈ ਇੱਕ ਗੌਂਸਲਾ ਬਣਾ ਦਵੋ ਅਤੇ ਕਬੂਤਰ ਉਹਦੇ ਵਿੱਚ ਆਂਡੇ ਦੇਣ ਲਈ ਵੀ ਆ ਜਾਂਦੇ ਹਨ ਜਿਹਦੀ ਕਿ ਉਹਦੇ ਬੱਚਿਆਂ ਨੂੰ ਪਾਲਣ ਲਈ ਬਹੁਤ ਵਧੀਆ ਹੁੰਦੇ ਆ ਇਸ ਕਰਕੇ ਅਸੀਂ ਇਸ ਤਰੀਕੇ ਨਾਲ ਕਬੂਤਰਾਂ ਨੂੰ ਆਕਰਸ਼ਿਤ ਕਰ ਸਕਦੇ ਹਾਂ